ਹਾਂਜੀ ਹਾਂਜੀ ਹਾਂਜੀ ਅਸੀਂ ਕੀ ਮਦਦ ਕਰ ਸਕਦੇ ਆ ਤੁਹਾਡੀ ਹਾਂਜੀ

ਓਕੇ ਜੀ ਕਿੰਨੀ ਉਮਰ ਆ ਬੱਚੇ ਦੀ ਅੱਛਾ ਜੀ ਬੇਟੀ ਹੈ ਜਾਂ ਬੇਟਾ ਓਕੇ ਹਾਂਜੀ ਫੋਨ ਤਾਂ ਬਹੁਤ ਬੱਚੇ ਚਲੋ ਜਿੱਦ ਕਰਦੇ ਜਦੋਂ ਅਸੀਂ ਪਹਿਲਾਂ ਅਸੀਂ ਘੱਟ ਦੇਖਾਂਗੇ ਪਹਿਲੀ ਗੱਲ ਤਾਂ ਇਹ ਆ ਉਹਨਾਂ ਕੋਲੇ ਫਿਰ ਬੱਚੇ ਉਹਨਾਂ ਨੂੰ ਆਪਾਂ ਖੇਡ ਲਾਵਾਂਗੇ ਉਹਨਾਂ ਦੇ ਨਾਲ ਆਪਾਂ ਖੇਡਾਂਗੇ ਜਾਂ ਬੱਚੇ ਨੂੰ ਬਾਹਰ ਖੇਡਣ ਭੇਜਾਂਗੇ ਕਿਸੇ ਵੀ ਤਰੀਕੇ ਤੁਸੀਂ ਉਹਦਾ ਧਿਆਨ ਪਾਸੇ ਕਰੋਗੇ ਤਾਂ ਹੀ ਬੱਚਾ ਫੋਨ ਵੇਖੋ ਤਾਂ ਹਟੂਗਾ ਤੇ ਬਾਕੀ ਉਹਨਾਂ ਨੂੰ ਖੁਰਾਕ ਬਾਰੇ ਉਹਨਾਂ ਨੂੰ ਹਰ ਰੋਜ਼ ਤੁਸੀਂ ਦੱਸੋਗੇ ਵੀ ਤੁਸੀਂ ਹਾਂਜੀ ਹਾਂਜੀ ਇਸੇ ਤੇ ਆਉਂਦੇ ਆ ਨਾ ਆਪਾਂ ਵੀ ਜੇ ਤੁਸੀਂ ਉਹਨੂੰ ਖੁਰਾਕ ਬਾਰੇ ਹਰ ਰੋਜ਼ ਦੱਸੋਗੇ ਵੀ ਬੱਚਾ ਇਹ ਆਪਣੇ ਵਾਸਤੇ ਚੰਗੀ ਚੀਜ਼ ਹ ਇਹ ਮਾੜੀ ਹੈ ਇਹ ਆਪਾਂ ਨਹੀਂ ਖਾਣੀ ਬਾਕੀ ਤੁਸੀਂ ਜਿਹੜਾ ਚਿੜਚਿੜਾ ਪਨ ਰਹਿੰਦਾ ਸਭ ਤੋਂ ਵੱਧ ਤੁਹਾਡਾ ਇਹਦੇ ਨਾਲ ਪਿਆਰ ਕਰਨਾ ਬਹੁਤ ਜਰੂਰੀ ਆ ਹਰ ਰੋਜ਼ ਤੁਸੀਂ ਉੱਠਣ ਵੇਲੇ ਸੁਬਹਾ ਉਹਨੂੰ ਇੱਕ ਵਾਰੀ ਜਰੂਰ ਹੀ ਪਿਆਰ ਕਰਨਾ ਦੋ ਤਿੰਨ ਮਿੰਟ ਸਵੇਰ ਦੇ ਜਿਹੜੇ ਹੈਗੇ ਆ ਉਹਨੂੰ ਬਹੁਤ ਹੀ ਪਿਆਰ ਨਾਲ ਉਠਾਉਣਾ ਤੇ ਪਿਆਰ ਹੀ ਉਹਨੂੰ ਕਰਨਾ ਤਿੰਨ ਮਿੰਟ ਘੱਟ ਤੋਂ ਘੱਟ ਤਿੰਨ ਮਿੰਟ ਵੱਧ ਪੰਜ ਕਰ ਸਕਦੇ ਆ ਤਿੰਨ ਮਿੰਟ ਤੋਂ ਜਦੋਂ ਉੱਠਦਾ ਬੱਚਾ ਉਹਨੂੰ ਬਹੁਤ ਜਿਆਦਾ ਪਿਆਰ ਕਰਨਾ ਏ ਫੇਰ ਉਹਨੂੰ ਕੁਝ ਵੀ ਖਵਾਉਣਾ ਪਿਆਉਣਾ ਹ ਤੇ ਉਹਨੂੰ ਸਾਰਾ ਦਿਨ ਇਹ ਗਾਈਡ ਕਰਨਾ ਵਾ ਜਦੋਂ ਵੀ ਉਹਨੇ ਖਾਣ ਪੀਣ ਲੱਗਿਆ ਵੀ ਬੱਚੇ ਆ ਤੇਰੇ ਵਾਸਤੇ ਗਲਤ ਹੈ ਇਹ ਸਹੀ ਹੈ ਹਰ ਇੱਕ ਜਿੱਦ ਪੂਰੀ ਨਹੀਂ ਕਰਨੀ ਤੇ ਹਰ ਇੱਕ ਵਾਰੀ ਉਹਨੂੰ ਨੋ ਨਹੀਂ ਬੋਲਣਾ ਨਹੀਂ ਨਹੀਂ ਕਹਿਣਾ ਵੀ ਨਹੀਂ ਨਹੀਂ ਇਹ ਨਹੀਂ ਗੱਲ ਕਹਿਣੀ ਹਾਂ ਉਹਨੂੰ ਆਰਾਮ ਦੇ ਨਾਲ ਜਦੋਂ ਕਿਤੇ ਕਿਤੇ ਉਹਦੀ ਡਿਮਾਂਡ ਪੂਰੀ ਕਰੋ ਕਿਤੇ ਨਹੀਂ ਵੀ ਕਰੋ ਨਾ ਵੀ ਜਰੂਰੀ ਹ ਉਹਦੇ ਵਾਸਤੇ ਹਾਂ ਵੀ ਜਰੂਰੀ ਆ ਤੇ ਜੇ ਅਸੀਂ ਉਹਨੂੰ ਇਹ ਚੀਜ਼ਾਂ ਤੋਂ ਹਟਾਉਣਾ ਤੇ ਸਭ ਤੋਂ ਵੱਧ ਆਪਾਂ ਨੂੰ ਪਿਆਰ ਕਰਾਂਗੇ ਪਿਆਰ ਜਿਹੜੀ ਹੈਗੀ ਆ ਸਭ ਤੋਂ ਵੱਧ ਵਧੀਆ ਚੀਜ਼ ਆ ਦੂਸਰੀ ਗੱਲ ਵੀ ਆਹਰ ਉਹਨੂੰ ਜਰੂਰ ਕੋਈ ਨਾ ਕੋਈ ਉਹਨੂੰ ਉਹਦਾ ਆਹਰ ਦਿਓ ਜਿਵੇਂ ਪੜ੍ਹ ਕੇ ਆਇਆ ਤੇ ਉਹਨੂੰ ਸਕਰੀਨ ਟਾਈਮ ਵੀ ਥੋੜਾ ਟਾਈਮ ਦਿਓ ਤੇ ਉਹਨੂੰ ਖੇਡਣ ਵਾਸਤੇ ਵੀ ਉਹਨੂੰ ਕਿਸੇ ਵੀ ਤਰੀਕੇ ਤੁਸੀਂ ਬੱਚਿਆਂ ਦੇ ਨਾਲ ਲੈ ਕੇ ਜਾਓ ਪਾਰਕ 'ਚ ਲੈ ਕੇ ਜਾਓ ਉਹਦੇ ਵਾਸਤੇ ਟਾਈਮ ਕੱਢੋ ਛੁੱਟੀ ਵਾਲੇ ਦਿਨ ਟਾਈਮ ਕੱਢੋ ਉਹਨੂੰ ਕਿਤੇ ਲੈ ਕੇ ਜਾਓ ਘੁੰਮਣ ਵਾਸਤੇ ਤੇ ਇਸ ਕਰਕੇ ਉਹਨੂੰ ਹੌਲੀ ਹੌਲੀ ਸਕੂਲ ਦੇ ਵਿੱਚ ਵੀ ਉਹਨੂੰ ਕਿਸੇ ਟੀਮ ਦੇ ਵਿੱਚ ਪਾਓ ਐ ਨਹੀਂ ਹੈਗਾ ਵੀ ਉਹ ਇਕੱਲਾ ਪੜ੍ਹੀ ਜਾਵੇ ਪੜ ਲੈ ਪੜ ਲੈ ਪੜ ਲੈ ਉਹਦੇ ਵਿੱਚ ਬੱਚਾ ਬੋਰ ਹੋ ਜਾਂਦਾ ਤੇ ਇਸ ਲਈ ਨਾਲੇ ਤਾਂ ਉਹਦੀ ਸਿਹਤ ਵਧੀਆ ਰਹੂਗੀ ਜਦੋਂ ਖੁਰਾਕ ਵਧੀਆ ਘਰ ਦੀ ਖੁਰਾਕ ਕੋਈ ਸਮਝ ਸਮਝੂਗਾ ਬੱਚਾ ਫਿਰ ਤੁਹਾਡੀ ਗੱਲ ਪਹਿਲੀ ਗੱਲ ਤਾਂ ਬੱਚਾ ਸੁਣੂਗਾ ਆਪਣੀ ਤਾਂ ਜੇ ਆਪਾਂ ਉਹਨੂੰ ਪਿਆਰ ਕਰਾਂਗੇ ਜੇ ਆਪਾਂ ਉਹਨੂੰ ਪਿਆਰ ਹੀ ਨਹੀਂ ਕਰਾਂਗੇ ਜਾਂ ਉਹਨੂੰ ਆਪਾਂ ਕਹੀ ਜਾਵਾਂਗੇ ਆਹ ਕਰ ਲਾ ਆਹ ਕਰ ਲਾ ਉਹ ਬੱਚਾ ਨਹੀਂ ਕਰੂਗਾ ਦੂਸਰੀ ਗੱਲ ਜਿਹੜੀ ਫੋਨ ਵੇਖਣ ਦੀ ਜਦੋਂ ਅਸੀਂ ਉਹਨੂੰ ਕਵਾਂਗੇ ਨਾ ਫੜ ਨਾ ਫੜ ਫਿਰ ਫੜੂਗਾ ਪਰ ਜੇ ਉਹ ਵੇਖੂਗਾ ਵੀ ਨਹੀਂ ਫੜ ਰਹੇ ਫੋਨ ਮੇਰੇ ਘਰ ਦੇ ਵੀ ਨਹੀਂ ਫੜ ਰਹੇ ਇਨਾਸ ਸਿਰਫ ਫੋਨ ਕਾਲ ਹੀ ਸੁਣਦੇ ਆ ਜਾ ਕੋਈ ਵੇਖਣੀ ਹ ਤਾਂ ਕੋਈ ਉਹੋ ਜਿਹੀ ਚੀਜ਼ ਵੇਖਣ ਨੂੰ ਦਿਓ ਜਿਵੇਂ ਆਪਣੀ ਸਰੀਰ ਵਾਸਤੇ ਚੰਗੀ ਖੁਰਾਕ ਜਰੂਰੀ ਆ ਉਸੇ ਹੀ ਤਰੀਕੇ ਫੋਨ ਦੇ ਵਿੱਚ ਜੋ ਵੀ ਤੁਹਾਡੇ ਕੰਟੈਂਟ ਆ ਰਿਹਾ ਵਾ ਉਸੇ ਤਰੀਕੇ ਉਹਦਾ ਉਹ ਕੰਟੈਂਟ ਵੀ ਜਰੂਰੀ ਆ ਚੰਗਾ ਕੰਟੈਂਟ ਜਰੂਰੀ ਆ ਤੇ ਤੇ ਹੋਰ ਠੀਕ ਜੀ ਇੰਨੀ ਕ ਅਸੀਂ ਤੁਹਾਡੀ ਮਦਦ ਕਰ ਸਕੇ